ਜੇਕਰ ਡਾਂਸ ਦੀ ਗੱਲ ਕੀਤੀ ਜਾਵੇ ਤਾਂ ਮੇਰੇ ਲਈ ਜਿਹੜਾ ਡਾਂਸ ਆ ਉਹ ਮੇਰੀ ਜ਼ਿੰਦਗੀ ਹੈ ਹਰ ਇੱਕ ਇਨਸਾਨ ਬੇਸ਼ੱਕ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਦੁਖੀ ਹੁੰਦਾ ਜਾਂ ਆਪਣੇ ਅੰਦਰਲੇ ਮਨੋਭਾਵਾਂ ਨੂੰ ਪ੍ਰਗਟ ਕਰਨ ਲਈ ਕਿਸੇ ਨਾ ਕਿਸੇ ਚੀਜ਼ ਦੀ ਸਹਾਇਤਾ ਲੈਂਦਾ ਅਤੇ ਡਾਂਸ ਮੇਰੇ ਲਈ ਉਹੀ ਕੁਛ ਆ ਮੈਂ ਦਿਨ ਬ ਦਿਨ ਇਸ ਚੀਜ਼ ਦੇ ਪ੍ਰਤੀ ਖੁਦ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਹੀ ਰਹਿੰਦੀ ਹਾਂ ਹਰ ਰੋਜ਼ ਖੁਦ ਨੂੰ ਇੱਕ ਨਵੀਂ ਪ੍ਰੇਰਨਾ ਦਿੰਦੀ ਹਾਂ ਤਾਂ ਕਿ ਮੈਂ ਆਪਣੇ ਇਸ ਹੁਨਰ ਨੂੰ ਹੋਰ ਜ਼ਿਆਦਾ ਸ਼ਿੰਗਾਰ ਸਕਾਂ ਸਹੀ ਕਰ ਸਕਾਂ ਅਤੇ ਇਸ ਦੇ ਵਿੱਚ ਮਹਾਰਤ ਹੈ ਜਿਹੜੀ ਉਹ ਹਾਸਿਲ ਕਰ ਸਕਾਂ ਮੈਂ ਹਰ ਰੋਜ਼ ਅੱਜ ਕੱਲ੍ਹ ਜਿਵੇਂ ਆਨਲਾਈਨ ਸਾਡੇ ਕੋਲ ਬਹੁਤ ਸਾਰਾ ਸਮੱਗਰੀ ਹੈ ਜਿਹੜੀ ਉਹ ਮੌਜੂਦ ਹੈ ਤਦ ਯੂਟੀਊਬ ਦੇ ਉੱਪਰ ਨਵੀਆਂ ਨਵੀਆਂ ਜਿਹੜੀਆਂ ਵੀਡੀਓਆਂ ਨੇ ਉਹਨਾਂ ਨੂੰ ਦੇਖ ਕੇ ਖੁਦ ਨੂੰ ਹੋਰ ਜ਼ਿਆਦਾ ਸੰਵਾਰਨ ਦੀ ਕੋਸ਼ਿਸ਼ ਕਰਦੀ ਹਾਂ ਇਸ ਤੋਂ ਇਲਾਵਾ ਮੈਂ ਸਾਡੇ ਹੀ ਖੁਦ ਦੇ ਸ਼ਹਿਰ ਮਾਨਸਾ ਦੇ ਵਿੱਚ ਇੱਕ ਡਾਂਸ ਅਕੈਡਮੀ ਨੂੰ ਵੀ ਜੁਆਇਨ ਕੀਤਾ ਹੈਗਾ ਉਥੋਂ ਮੈਂ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੀ ਹੈਗੀ ਤਾਂ ਕਿ ਮੈਂ ਆਪਣੇ ਇਸ ਹੁਨਰ ਨੂੰ ਹੋਰ ਜ਼ਿਆਦਾ ਚਮਕਾ ਸਕਾਂ